ਹੈਲੋ ਕਿਆ ਹਾਲ ਹੈ ਤੇਰਾ ਵਧੀਆ ਮੈਂ ਵੀ ਤੂੰ ਦੱਸ ਹੋਰ ਕਿਵੇਂ ਚੱਲਦਾ ਤੇਰਾ ਸਭ ਵਧੀਆ ਚਲਦਾ ਹਾਂ ਹਾਂ ਮੈਂ ਵੀ ਵਧੀਆ ਯਾਰ ਮੈਂ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਹੁਣ ਮਤਲਬ ਜੋ ਮੇਰੀਆਂ ਹੁਣ ਅੱਗੇ ਛੁੱਟੀਆਂ ਆ ਰਹੀਆਂ ਨੇ ਮੈਂ ਇਹਨਾਂ ਛੁੱਟੀਆਂ ਦੇ ਵਿੱਚ ਘੁੰਮਣਾ ਘੁੰਮਣ ਜਾਣਾ ਚਾਹੁੰਦਾ ਹਾਂ ਅਤੇ ਜਿਹੜੀ ਮੇਰੀ ਛੁੱਟੀਆਂ ਹੈ ਇਹਨਾਂ ਛੁੱਟੀਆਂ ਦੇ ਵਿੱਚ ਮੈਂ ਕਿਤੇ ਵਧੀਆ ਜੀ ਜਗ੍ਹਾ ਜਾਣਾ ਚਾਹੁੰਦੀ ਹਾਂ ਅਤੇ ਜਿਹੜੀਆਂ ਛੁੱਟੀਆਂ ਹੈ ਇਹਦੇ ਵਿੱਚ ਤੂੰ ਦੱਸ ਮੈਨੂੰ ਕਿ ਮੈਂ ਕਿਹੜੀ ਜਗ੍ਹਾ ਜਾਵਾਂ ਵੈਸੇ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੀ ਹੈਲ ਮਦਦ ਕਰੇ ਕਿ ਮੈਂ ਕੋਈ ਵਧੀਆ ਜਿਹੀ ਜਗ੍ਹਾ ਘੁੰਮਣ ਦੇ ਲਈ ਜਾਵਾਂ ਵੈਸੇ ਇੱਕ ਦੋ ਜਗ੍ਹਾ ਤਾਂ ਮੈਂ ਵੀ ਸੋਚੀਆਂ ਹੋਈਆਂ ਹਨ ਅਤੇ ਤੂੰ ਮੇਰੀ ਇਸ ਚੀਜ਼ ਦੇ ਵਿੱਚ ਮਦਦ ਕਰ ਕਿ ਮੈਂ ਕਿਹੜੀ ਜਗ੍ਹਾ ਜਾਵਾਂ ਅਤੇ ਉਸ ਉਸ ਜਗ੍ਹਾ ਜਾਣ ਦੇ ਲਈ ਮੈਨੂੰ ਰੇਲ ਗੱਡੀ ਮਤਲਬ ਰੇਲ ਲੈਣ ਦੇ ਲਈ ਟ੍ਰੇਨ ਲੈਣ ਦੇ ਲਈ ਮਤਲਬ ਮੈਂ ਕਿੱਥੋਂ ਮੈਨੂੰ ਕਿਸ ਸਮੇਂ ਮਤਲਬ ਕਿੱਥੋਂ ਕਿੱਥੋਂ ਮਿਲੇਗੀ ਮੈਨੂੰ ਉਹਦੀ ਪੂਰੀ ਜਿਹੜੀ ਜਾਣਕਾਰੀ ਹੈ ਤੂੰ ਹੀ ਮੈਨੂੰ ਦੇ ਦੀ ਕਿਉਂਕਿ ਯਾਰ ਮੈਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ ਨਹੀਂ ਹੈ ਵੈਸੇ ਮੈਂ ਤਾਂ ਘੁੰਮਣ ਜਾਣ ਬਾਰੇ ਸ਼ਿਮਲਾ ਜਾਣ ਬਾਰੇ ਸੋਚਿਆ ਸੀ ਸ਼ਿਮਲਾ ਜਾਣ ਤੋਂ ਬਾਰੇ ਮੈਂ ਪਹਿਲਾਂ ਸੋਚਿਆ ਸੀ ਕਿ ਮੈਂ ਇੱਥੇ ਤੋਂ ਬੱਸ ਲਵਾਂ ਇੱਥੇ ਤੋਂ ਬੱਸ ਲੈ ਕੇ ਮੈਂ ਜਾਵਾਂ ਚੰਡੀਗੜ੍ਹ ਚੰਡੀਗੜ੍ਹ ਤੋਂ ਮੈਂ ਸੋਚ ਰਿਹਾ ਸੀਗਾ ਕਿ ਮੈਂ ਕਾਲਕਾ ਜਾਵਾਂ ਕਾਲਕਾ ਕਾਲਕਾ ਬੱਸ ਤੱਕ ਜਾ ਕੇ ਫਿਰ ਮੈਂ ਕਾਲਕਾ ਤੋਂ ਟਰੇਨ ਲੈ ਕੇ ਸ਼ਿਮਲਾ ਜਾਣਾ ਚਾਹੁਨੀ ਚਾਹੁੰਦੀ ਹਾਂ ਕਿ ਤੂੰ ਮੈਨੂੰ ਇਹਦੇ ਬਾਰੇ ਜਾਣਕਾਰੀ ਲੈ ਕੇ ਦੱਸ ਕਿ ਜੇ ਮੈਂ ਜ ਸ਼ਿਮਲੇ ਤੋਂ ਕਾਲਕਾ ਤੋਂ ਸ਼ਿਮਲੇ ਦੀ ਟ੍ਰੇਨ ਲਈ ਹੈ ਤਾਂ ਉਹ ਟਰੇਨ ਮਤਲਬ ਮੈਨੂੰ ਕਦੋਂ ਮਿਲੇਗੀ ਕਿੰਨੇ ਵਜੇ ਮਿਲੇਗੀ ਔਰ ਕਿੰਨੇ ਪੈਸੇ ਲੱਗਣਗੇ ਇਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਲੈ ਕੇ ਦੱਸੀ ਕਿਉਂਕਿ ਯਾਰ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਇਸ ਚੀਜ਼ 'ਚ ਤੂੰ ਮੇਰੀ ਮਦਦ ਕਰ ਦੇ ਵੈਸੇ ਸੋਚਿਆ ਤਾਂ ਮੈਂ ਸ਼ਿਮਲਾ ਜਾਣ ਬਾਰੇ ਜੇ ਇਕ ਵਾਰੀ ਤੂੰ ਵਧੀਆ ਜਗ੍ਹਾ ਵੀ ਤੈਨੂੰ ਕੋਈ ਲੱਗਦੀ ਹੈ ਤਾਂ ਤੂੰ ਮੈਨੂੰ ਦੱਸ ਮੈਂ ਛੁੱਟੀਆਂ ਦੇ ਵਿੱਚ ਕਿੱਥੇ ਜਾਵਾਂ ਔਰ ਮੈਨੂੰ ਪੂਰੀ ਜਾਣਕਾਰੀ ਵੀ ਦੇ ਦੀ ਅਤੇ ਮੈਂ ਕਿੱਦਾਂ ਜਾਵਾਂ ਜਿੱਥੇ ਮੈਨੂੰ ਖਰਚਾ ਘੱਟ ਹੋਏ ਅਤੇ ਟ੍ਰੇਨ ਦੇ ਵਿੱਚ ਜਾਣਾ ਵਧੀਆ ਹੈ ਜਾਂ ਫਿਰ ਕਿਸੇ ਬੱਸ ਬੁਸ 'ਚ ਜਾਣਾ ਵਧੀਆ ਹੈ ਵੈਸੇ ਤੂੰ ਮੈਨੂੰ ਟ੍ਰੇਨ ਦੀ ਪੂਰੀ ਜਾਣਕਾਰੀ ਦਈ ਕਿ ਟ੍ਰੇਨ ਮੈਨੂੰ ਮਿਲ ਸਕਦੀ ਹੈ ਪੂਰੀ ਜਾਂਚ ਇਸ ਚੀਜ਼ ਦੇ ਬਾਰੇ ਕਰਕੇ ਮੈਨੂੰ ਪੂਰੀ ਜਾਣਕਾਰੀ ਦੇ ਦਈ ਠੀਕ ਹੈ